ਮੈਂ ਮੈਰਿਜ 'ਤੇ ਜਾਣਾ ਸੀ ਮੈਂ ਆਨਲਾਈਨ ਡਰੈਸ ਆਰਡਰ ਕੀਤੀ ਪਰ ਉਹ ਡਰੈਸ ਬਹੁਤ ਜ਼ਿਆਦਾ ਹੀ ਗੰਦੀ ਆਈ ਮੈਨੂੰ ਦੇਖ ਕੇ ਬਹੁਤ ਦੁੱਖ ਹੋਇਆ ਵੀ ਮੈਂ ਇੰਨੀ ਵਧੀਆ ਡਰੈਸ ਮੰਗਵਾਈ ਸੀ ਪਰ ਬਹੁਤ ਜ਼ਿਆਦਾ ਗੰਦੀ ਆਈ ਡਰੈਸ ਡਰੈਸ ਬਹੁਤ ਫਟੀ ਹੋਈ ਸੀ ਅਤੇ ਜਿਵੇਂ ਦਿਖਾਇਆ ਸੀ ਉਹਨਾਂ ਨੇ ਉਸਦਾ ਬਿਲਕੁਲ ਹੀ ਉਲਟਾ ਆਇਆ ਮੈਂ ਆਪਣੀ ਕਲੋਸ ਫਰੈਂਡ ਦੀ ਮੈਰਿਜ 'ਤੇ ਜਾਣਾ ਸੀ ਪਰ ਉਹ ਵੀ ਜਾਣਾ ਮੇਰਾ ਕੈਂਸਲ ਹੋ ਗਿਆ ਅਸੀਂ ਬਹੁਤ ਪਲੈਨ ਬਣਾਇਆ ਸੀ ਉੱਥੇ ਜਾ ਕੇ ਇੰਜੋਆਏ ਕਰਾਂਗੇ ਭੰਗੜਾ ਪਾਵਾਂਗੇ ਬਹੁਤ ਜ਼ਿਆਦਾ ਮਸਤੀ ਕਰਾਂਗੇ ਪਰ ਉਹ ਸਾਰਾ ਕੈਂਸਲ ਹੋ ਗਿਆ ਅੱਜ ਤੋਂ ਬਾ ਮੇਰੇ ਸਾਰੇ ਪੈਸੇ ਖਰਾਬ ਹੋ ਗਏ ਅੱਜ ਤੋਂ ਬਾਅਦ ਮੈਂ ਇਹ ਪ੍ਰੋਡਕਟ ਕਦੇ ਨਹੀਂ ਮੰਗਾਊਂਗੀ ਮੈਂ ਸੋਚਿਆ ਸੀ ਵੀ ਬਹੁਤ ਸਾਰੀ ਇੰਜੋਇਮੈਂਟ ਕਰਾਂਗੇ ਉੱਥੇ ਅਤੇ ਬਹੁਤ ਜ਼ਿਆਦਾ ਵਧੀਆ ਡਰੈਸ ਮੰਗਵਾਈ ਸੀ ਪਰ ਇੱਦਾਂ ਦਾ ਕੁਛ ਨਹੀਂ ਹੋਇਆ ਸਾਰਾ ਹੀ ਉਲਟਾ ਹੋਇਆ ਅਤੇ ਮੈਂ ਸੋਚ ਰਹੀ ਸੀ ਇਹ ਇਹਦਾ ਨੈਗੇਟਿਵ ਇੰਪ੍ਰੈੱਸ ਪਿਆ ਬਹੁਤ ਜ਼ਿਆਦਾ ਹੀ ਪ੍ਰੋਬਲਮ ਆਈ ਮੈਨੂੰ ਅਤੇ ਮੈਂ ਸੋਚ ਰਹੀ ਸੀ ਕਿ ਮੇਰੀ ਡਰੈਸ ਕਾਰਨ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਗੇ ਤੋਂ ਮੈਂ ਕਦੇ ਵੀ ਔਨਲਾਈਨ ਡਰੈਸ ਨਹੀਂ ਮੰਗਵਾਊਂਗੀ